ਹੈਲੋ ਨਮਸਕਾਰ ਜੀ ਮੈਂ ਰਾਜ ਕੁਮਾਰ ਅਰੋੜਾ ਅੰਮ੍ਰਿਤਸਰ ਤੋਂ ਬੋਲ ਰਿਹਾ ਮੈਂ ਨਾ ਇੱਕ ਪ੍ਰੋਡਕਟ ਮੰਗਵਾਇਆ ਸੀ ਲਾਵਾ ਦਾ ਮੋਬਾਈਲ ਫੋਨ ਮੰਗਵਾਇਆ ਸੀ ਜਿਹਦੀ ਮੈਨੂੰ ਰੇਟਿੰਗ ਕਾਫੀ ਅੱਛੀ ਲੱਗੀ ਅਤੇ ਅਤੇ ਮੈਂ ਕਿਹਾ ਚਲੋ ਆਪਣੇ ਵਾਸਤੇ ਅਤੇ ਜਾਂ ਬੱਚਿਆਂ ਦੇ ਪੇਪਰ ਪੁਪਰ ਸੀ ਇਹਨਾਂ ਵਾਸਤੇ ਖਰੀਦ ਲਈਏ ਪਰ ਡਿਲੀਵਰੀ ਬੋਆਏ ਜਦੋਂ ਡਿਲੀਵਰੀ ਕਰਨ ਆਇਆ ਤਾਂ ਉਹ ਮੈਨੂੰ ਫੋਨ ਕੀਤਾ ਕਿ ਮੈਂ ਤੁਹਾਨੂੰ ਕਰਨ ਡਿਆ ਪਰ ਉਸ ਦਿਨ ਉਹ ਡਿਲੀਵਰੀ ਦੇਣ ਆਇਆ ਹੀ ਨਹੀਂ ਅਤੇ ਉਹ ਫਿਰ ਅਗਲੇ ਦਿਨ ਆਇਆ ਇੱਕ ਦਿਨ ਲੇਟ ਹੋ ਗਿਆ ਇਹ ਵੀ ਬੜੀ ਮਾੜੀ ਗੱਲ ਹੋਈ ਮੇਰੇ ਨਾਲ ਕਿਉਂਕਿ ਮੇਰੇ ਬੱਚਿਆਂ ਦੇ ਇਗਜ਼ਾਮ ਪੇਪਰ ਸੀ ਅਤੇ ਮੈਂ ਕਿਹਾ ਚਲੋ ਹੁਣ ਮੋਬਾਈਲ 'ਤੇ ਵੀ ਅੱਜ ਕੱਲ੍ਹ ਜਿਹੜੇ ਪੇਪਰ ਹੁੰਦੇ ਹੁੰਦੇ ਆ ਅਤੇ ਵੀ ਇਸ ਪਿੱਛੇ ਇਗਜ਼ਾਮ ਸੀ ਉਹਨਾਂ ਨੂੰ ਬੱਚਿਆਂ ਨੂੰ ਬੜੀ ਨੀਡ ਸੀ ਅਤੇ ਇਸ ਕਾਰਨ ਅਤੇ ਇਸ ਇਹ ਫਿਰ ਪ੍ਰੋਡੈਕਟ ਦਾ ਮੈਨੂੰ ਜਦੋਂ ਕਿ ਮੈਂ ਮੰਗਵਾਇਆ ਸੋਨੀ ਦਾ ਸੀ ਜਦੋਂ ਕਿ ਉਹਨੂੰ ਖੋਲ੍ਹ ਕੇ ਦੇਖਿਆ ਅਤੇ ਉਹਦੇ ਵਿੱਚੋਂ ਨਿਕਲਿਆ ਲਾਵਾ ਦਾ ਇਹ ਨਹੀਂ ਸੋਰੀ ਲਾਵਾ ਦਾ ਮੰਗਵਾਇਆ ਸੀ ਅਤੇ ਵਿੱਚੋਂ ਸੋਨੀ ਦਾ ਨਿਕਲਿਆ ਅਤੇ ਜੋ ਹੁਣ ਦੇ ਇਸ ਮੇਰੇ ਇਸ ਕੰਮ ਦਾ ਨਹੀਂ ਅਤੇ ਮੈਂ ਚਾਹੁੰਦਾ ਹਾਂ ਕਿ ਮੇਰੇ ਜਾਂ ਤਾਂ ਪੈਸੇ ਵਾਪਸ ਮਿਲਣ ਅਤੇ ਜਾਂ ਮੈਨੂੰ ਪ੍ਰੋਡੈਕਟ ਚੇਂਜ ਕਰਕੇ ਦਿੱਤਾ ਜਾਵੇ ਇਸ ਵੇ ਇਹਦਾ ਮੈਨੂੰ ਐਕਸਪੀਰੀਅੰਸ ਬੜਾ ਹੀ ਨੈਗਟਿਵ ਮੈਨੂੰ ਲੱਗਾ ਜਦੋਂ ਕਿ ਅੱਛੀਆਂ ਅੱਛੀਆਂ ਕੰਪਨੀਆਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜਿਹੜੀ ਚੀਜ਼ ਮੰਗਵਾਈ ਹੋਵੇ ਉਹੀ ਮਿਲਣੀ ਚਾਹੀਦੀ ਹੈ ਇਹਦੀ ਇਸ ਸਬੰਧੀ ਸੈਟੀਸਫੈਕਸ਼ਨ ਹੁੰਦੀ ਹੈ ਚਲੋ ਅੱਗੋ ਤੋਂ ਪਲੀਜ਼ ਕਿਰਪਾ ਇਹ ਗੱਲ ਦਾ ਧਿਆਨ ਰੱਖਿਆ ਜਾਵੇ ਸ਼ੁਕਰੀਆ